ਸਾਡੇ ਇਲਾਕੇ ਵਿੱਚ ਲੋਕ ਜ਼ਿਆਦਾਤਰ ਧਾਰਮਿਕ ਜਗ੍ਹਾਵਾਂ ਵਿੱਚ ਜਾਣ ਦੀ ਰੁਚੀ ਰੱਖਦੇ ਹਨ ਕਿਉਂਕਿ ਧਾਰਮਿਕ ਜਗ੍ਹਾਵਾਂ ਵਿੱਚ ਜਾ ਕੇ ਉਹਨਾਂ ਨੂੰ ਆਪਣੀ ਖੁਸ਼ੀ ਮਿਲਦੀ ਹੈ ਜਿੱਦਾਂ ਕਿ ਗੁਰਦੁਆਰੇ ਹੋ ਗਏ ਮੰਦਰ ਹੋ ਗਈ ਇੱਦਾ ਇੱਦਾਂ ਕਰਕੇ ਬਹੁਤ ਗੁਰਦੁਆਰੇ ਹਨ ਜਿੱਦਾਂ ਕਿ ਇੱਕ ਗੁਰਦੁਆਰਾ ਪਾਕਿਸਤਾਨ ਵੱਲ ਹੈ ਅੰਮ੍ਰਿਤਸਰ ਠੀਕ ਹੈ ਹਰ ਹਜ਼ੂਰ ਸਾਹਿਬ ਹਜ਼ੂਰ ਸਾਹਿਬ ਜਿੱਥੇ ਕਿ ਲੋਕ ਜਾਂਦੇ ਹੈ ਆਪਣੇ ਮਨ ਦੀ ਸ਼ਾਂਤੀ ਕਰਨ ਲਈ ਹੋਰ ਵੀ ਬਹੁਤ ਸਾਰੀ ਜਗ੍ਹਾਵਾਂ ਹਨ ਪਰ ਸਾਡੇ ਇਲਾਕੇ ਵਿੱਚੋਂ ਜ਼ਿਆਦਾਤਰ ਲੋਕ ਆਪਣੀ ਮਨ ਦੀ ਸ਼ਾਂਤੀ ਲਈ ਭਗਵਾਨ ਦੇ ਦਰ ਜਾਣ ਦੀ ਜ਼ਿਆਦਾ ਇੱਛਾ ਰੱਖਦੇ ਹਨ ਕਿਉਂਕਿ ਉੱਥੇ ਉਹਨਾਂ ਨੂੰ ਸੁੱਖ ਸ਼ਾਂਤੀ ਮਿਲਦੀ ਹੈ ਲੋਕ ਆਪਣਾ ਪੂਰਾ ਟੱਬਰ ਲੈ ਕੇ ਜਾਂਦੇ ਹਨ ਅਰਦਾਸ ਕਰਦੇ ਹਨ ਕਿ ਅਸੀਂ ਅਗਲੀ ਵਾਰੀ ਵੀ ਆਵਾਂਗੇ ਤੁਹਾਡੇ ਇੱਥੇ ਮੱਥਾ ਟੇਕਣ ਬਾਬਾ ਜੀ ਸਾਡੇ 'ਤੇ ਮਿਹਰ ਮਿਹਰ ਕਰਿਓ